ਹੈਲੋ ਹਾਂਜੀ ਸਰ ਮੈਂ ਨਾ ਇੱਕ ਸੈਅ ਆਪਣਾ ਔਨਲਾਈਨ ਕੁਛ ਸ਼ੋਪਿੰਗ ਦੇ ਵਿੱਚ ਏ ਸੀ ਮੰਗਵਾਇਆ ਸੀਗਾ ਤੁਹਾਡੇ ਤੋਂ ਅਤੇ ਏ ਸੀ ਜਿਹੜਾ ਹੈਗਾ ਹੈ ਉਹ ਕੁਛ ਸਹੀ ਨਹੀਂ ਹੈ ਉਸ ਦਾ ਵਰਤੋਂ ਮੈਂ ਕਰਕੇ ਦੇਖੀ ਆ ਅਤੇ ਉਹ ਸਹੀ ਨਹੀਂ ਮਿਲਿਆ ਉਹਦੇ ਵਿੱਚ ਜੋ ਵੀ ਉਹਦੇ ਉੱਪਰ ਜੋ ਵੀ ਆਪਣਾ ਬਾਹਰ ਉਹਦੇ ਉੱਤੇ ਪਰਫੋਰਮਾ ਲਿਖਿਆ ਹੁੰਦਾ ਹੈ ਕਿ ਵੀ ਉਹ ਇਤਨੇ ਵੋਰਟ ਦਾ ਹੈ ਅਤੇ ਇਤਨੀ ਬੱਤੀ ਦੀ ਜਿਹੜੀ ਹੈਗੀ ਹੈ ਉਹ ਖਪਤ ਕਰੇਗਾ ਅਤੇ ਉਹ ਜ਼ਰੂਰਤ ਤੋਂ ਜ਼ਿਆਦਾ ਬੱਤੀ ਦੀ ਖਪਤ ਕਰ ਰਿਹਾ ਹੈ ਤੇ ਅਤੇ ਉਹਦੀ ਕੂਲਿੰਗ ਵੀ ਕੁਛ ਜਿਹੜੀ ਹੈਗੀ ਹੈ ਉਹ ਵੀ ਪ੍ਰੋਪਰ ਸਹੀ ਨਹੀਂ ਆ ਰਹੀ ਹੈਗੀ ਹੈ ਤੇ ਉਹ ਜਿਹੜਾ ਏ ਸੀ ਹੈ ਉਹ ਕੁਛ ਸਹੀ ਨਹੀਂ ਲੱਗ ਰਿਹਾ ਮੈਨੂੰ ਅਤੇ ਉਹਦਾ ਜੋ ਵੀ ਹੈ ਆਪਣਾ ਮੈਨੂੰ ਕੁਛ ਜਚਿਆਂ ਨਹੀਂ ਉਹ ਆਪਣਾ ਘਰ ਦੇ ਵਿੱਚ ਉਸ ਦਾ ਜਿਹੜਾ ਵੀ ਹੈ ਆਪਣਾ ਬੱਤੀ ਦਾ ਖਰਚਾ ਵੀ ਬਹੁਤ ਜ਼ਿਆਦਾ ਲੈ ਰਿਹਾ ਹੈ ਅਤੇ ਉਸਦੀ ਕੂਲਿੰਗ ਵੀ ਇਤਨੀ ਜ਼ਿਆਦਾ ਨਹੀਂ ਆ ਅਤੇ ਉਹਦੀ ਇੱਕ ਹੋਰ ਵੀ ਆ ਕਿ ਵੋ ਉਹ ਕੁਛ ਆਵਾਜ਼ ਵੀ ਕਰਦਾ ਹੈਗਾ ਹੈ ਜਿਸ ਦੇ ਨਾਲ ਕੁਛ ਰਾਤ ਨੂੰ ਸੋਣ ਲੱਗਿਆ ਪਰੇਸ਼ਾਨੀ ਵੀ ਹੁੰਦੀ ਹੈ ਇਸ ਉਹ ਵਾਤਾਅਨੂਕੁਲਿਤ ਬਹੁਤ ਹੀ ਮਤਲਬ ਮੇਰੇ ਹਿਸਾਬ ਨਾਲ ਤਾਂ ਸਹੀ ਨਹੀਂ ਹੈ ਉਸ ਦਾ ਮੈਨੂੰ ਇਹ ਵਾਲਾ ਐਕਸਪੀਰੀਅੰਸ ਬਿਲਕੁਲ ਹੀ ਅੱਛਾ ਨਹੀਂ ਲੱਗਿਆ ਜਿਹੜਾ ਪ੍ਰੋਡਕਟ ਮੈਂ ਉਹ ਮੰਗਵਾਇਆ ਸੀ ਔਨਲਾਈਨ ਉਹ ਮੇਰੇ ਮਤਲਬ ਮੇਰੇ ਉਹਦੇ ਮੁਤਾਬਿਕ ਨਹੀਂ ਹੈਗਾ ਹੈ